ਬਾਹਰੀ ਗਤੀਵਿਧੀਆਂ ਉਹ ਹੁੰਦੀਆਂ ਹਨ ਜੋ ਘਰ ਤੋਂ ਬਾਹਰ ਖੇਡੀਆਂ ਜਾਂਦੀਆਂ ਹਨ ਅਤੇ ਸਾਹਸੀ ਖੇਡਾਂ ਉਹ ਹੁੰਦੀਆਂ ਹਨ ਜਿਹਨਾਂ ਵਿੱਚ ਸਾਹਸ ਦੀ ਲੋੜ ਹੁੰਦੀ ਹੈ ਜਿਵੇਂ ਅਸੀਂ ਦੇਖਿਆ ਹੈ ਕਿ ਰਾਫਟਿੰਗ ਟਰੈਕਿੰਗ ਅਤੇ ਰੋਪ ਕਲਾਈਮਿੰਗ ਵਿੱਚ ਮੁੱਖ ਹੁੰਦੀਆਂ ਹਨ ਇਸ ਤਰ੍ਹਾਂ ਦੀ ਗਤੀਵਿਧੀਆਂ ਵਿੱਚ ਗਤੀਵਿਧੀਆਂ ਲਈ ਸਾਹਸ ਦੀ ਲੋੜ ਹੁੰਦੀ ਹੈ ਇਸ ਤਰ੍ਹਾਂ ਦੀ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ ਤਾਂ ਜੇ ਬੰਦੇ ਵਿੱਚ ਸਾਹਸ ਹੋਵੇ ਬੱਚਿਆਂ ਵਿੱਚ ਸਾਹਸ ਵੱਧ ਹੋਣ ਨਾਲ ਉਹਨਾਂ ਦੇ ਖੇਡਣ ਦੀ ਸ਼ਕਤੀ ਅਤੇ ਇਸ ਗਤੀਵਿਧੀਆਂ ਦੇ ਕਰਨ ਦੀ ਸ਼ਕਤੀ ਕੀ ਹੁੰਦੀ ਹੈ ਵੱਧ ਜਾਂਦੀ ਹੈ ਅਤੇ ਉਹ ਇਸ ਖੇਡਾਂ ਨੂੰ ਕਰ ਕਰ ਸਕਦੇ ਹੈ ਇਹ ਤਰ੍ਹਾਂ ਦੀ ਖੇਡ ਗਤੀਵਿਧੀਆਂ ਕਰਨ ਲਈ ਲੋਕ ਬੱਚੇ ਬਹੁਤ ਦੂਰ ਦੂਰ ਤੱਕ ਆਦ ਦੂਰ ਦੂਰ ਤੱਕ ਆਉਂਦੇ ਹਨ ਅਤੇ ਇਨਾਮ ਵੀ ਲਿਆਉਂਦੇ ਹਨ ਜਿਵੇਂ ਕਿ ਰੋਪ ਕਲਾਈਮਿੰਗ ਰੋਪ ਕਲਾਈਮਿੰਗ ਨੂੰ ਪੰਜਾਬੀ ਵਿੱਚ ਪੱਥਰੇ ਚੜ੍ਹਨਾ ਵੀ ਕਿਹਾ ਜਾਂਦਾ ਹੈ ਇਹ ਇੱਕ ਸਖ਼ਤ ਸਪੋਰਟ ਹੈ ਜਿਸ ਵਿੱਚ ਵਿਅਕਤੀ ਪਹਾੜੀ ਪੱਥਰਾਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਦੀ ਸਹਿਜਤਾ ਅਤੇ ਟੈਕਨੀਕਲ ਹੁਨਰ ਦੀ ਲੋੜ ਹੁੰਦੀ ਹੈ ਇਸ ਖੇਡ ਵਿੱ ਇਸ ਖੇਡ ਆਪਣੇ ਲਿਮਿਟਸ ਕਰਨ ਦੀ ਵਿਸ਼ੇਸ਼ ਵਿਅਕਤੀ ਦੀ ਮੱਦਦ ਹੁੰਦੀ ਹੈ ਅਤੇ ਨਵੀਆਂ ਉੱਚੀਆਂ ਉੱਚਾਈਆਂ ਤੱਕ ਪਹੁੰਚਣ ਦਾ ਅਹਿਸਾਸ ਹੁੰਦਾ ਹੈ ਪੰਜਾਬੀ ਖੇਡਾਂ ਵਿੱਚ ਰਾਫਟਿੰਗ ਵੀ ਇੱਕ ਮਹੱਤਵਪੂਰਣ ਹੈ ਇਹ ਗਤੀਵਿਧੀ ਜੋਸ਼ ਔਰ ਖੁਸ਼ੀ ਭਰੀ ਸਵਾਰੀ ਹੈ ਜਿਸ ਵਿੱਚ ਲੋਕ ਇੱਕ ਰਾਫਟ ਯਾਨੀ ਕਿ ਬੋਟ ਵਿੱਚ ਬੈਠ ਕੇ ਨਦੀ ਦੇ ਪਾਣੀਆਂ ਵਿੱਚ ਚਲਾਉਂਦੇ ਹਨ ਇਹ ਸਪੋਰਟ ਵਾ ਵਾਹਿਗੁਰੂ ਦੇ ਖੇਡ ਵਿੱਚ ਭੂਮਿਕਾ ਬਹੁ ਪਾਉਂਦੀ ਹੈ ਅਤੇ ਪਾਣੀ ਦੇ ਪਤਾਰਵਾਂ ਨੂੰ ਨ ਨਵੀਂਗੇ ਅਤੇ ਨਵੇਂ ਜਗ੍ਹਾ ਦਰਸਾਉਂਦੀ ਹੈ ਇਹ ਖੇਡਾਂ ਬਹੁਤ ਜ਼ਰੂਰੀ ਹਨ